ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਓ ਕਿਸ ਕੰਮ ਲਈ ਆਏ ਕਿਰਾਏ 'ਤੇ ਹੈਗਾ ਉੱਪਰ ਖਾਲੀ ਹੈਗੇ ਆ ਦੋ ਕਮਰੇ ਇੱਕ ਪੋਰਸ਼ਨ ਆਪਣਾ ਬਣਿਆ ਹੋਇਆ ਹੈਗਾ ਦੋ ਕਮਰੇ ਹੈਗੇ ਆ ਅਤੇ ਹਾਂ ਦੋਨਾਂ ਨਾਲ ਅਟੈਚ ਬਾਥਰੂਮ ਹੈਗੇ ਆ ਅਤੇ ਥੋੜ੍ਹਾ ਜਿਹਾ ਖੁੱਲ੍ਹਾ ਖੁੱਲ੍ਹਾ ਏਰੀਆ ਜਿਹਾ ਵੀ ਬਣਿਆ ਹੋਇਆ ਹੈਗਾ ਅਤੇ ਸਟੋਰ ਨਹੀਂ ਹੈਗਾ ਸਟੋਰ ਨਹੀਂ ਹੈਗਾ ਅੱਜ ਕੱਲ੍ਹ ਨਾ ਹਾਂ ਉਹ ਹੈਗਾ ਕਮਰਾ ਤੁਹਾਨੂੰ ਦਿਖਾ ਦਿੰਦਾ ਆਜੋ ਤੁਸੀਂ ਦੇਖ ਲਿਓ ਅਤੇ ਕਿੰਨੇ ਪ੍ਰੋ ਹਾਂ ਅਤੇ ਫੈਮਲੀ ਨਾਲ ਆ ਜਿਓ ਤੁਸੀਂ ਕੀ ਕੰਮ ਕਰਦੇ ਹੋ ਅਤੇ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਨੇ ਪੰਜ ਜਣੇ ਓ ਫਿਰ ਤੁਸੀਂ ਪੰਜ ਤੋਂ ਬਹੁਤ ਪਰਿਵਾਰ ਵੱਡਾ ਤੁਹਾਡਾ ਤਾਂ ਫਿਰ ਇੱਥੇ ਤਾਂ ਸ਼ੋਰ ਸ਼ਰਾਬਾ ਜ਼ਿਆਦਾ ਹੋਏਗਾ ਅੱਛਾ ਅੱਛਾ ਅਤੇ ਦੇਖੋ ਦਸ ਹਜ਼ਾਰ ਰੁਪਇਆ ਮਹੀਨੇ ਦਾ ਕਿਰਾਇਆ ਪਏਗਾ ਤੁਹਾਨੂੰ ਹਾਂ ਨਹੀਂ ਨਹੀਂ ਨਾਲ ਫਿਰ ਨਾਲ ਫਿਰ ਤੁਹਾਨੂੰ ਤੁਹਾਡੇ ਨਾਲ ਫਿਰ ਤੁਹਾਨੂੰ ਸਾਡੇ ਨਾਲ ਜਿਹੜਾ ਰੈਂਟ ਦਾ ਐਗਰੀਮੈਂਟ ਕਰਨਾ ਪਏਗਾ ਉਹ ਇੱਕ ਸਾਲ ਦਾ ਐਗਰੀਮੈਂਟ ਹੋਏਗਾ ਉਹਦੇ 'ਤੇ ਫਿਰ ਆਪਾਂ ਜਿਹੜੀਆਂ ਆਪਣੀਆ ਟਰਮ ਐਂਡ ਕੰਡੀਸ਼ਨ ਹੋਣਗੀਆਂ ਉਹ ਲਿਖ ਲਾਂਗੇ ਵੀ ਕੀ ਕੀ ਹੈਗੀਆਂ ਬਿਜਲੀ ਪਾਣੀ ਦਾ ਖਰਚਾ ਅੱਡ ਹੋਵੇਗਾ ਨਹੀਂ ਠੀਕ ਹੈ ਚਲੋ ਉਹ ਪਤਾ ਕੀ ਹੈ ਜੀ ਥੋੜ੍ਹੀ ਸੇਫਟੀ ਰਹਿੰਦੀ ਉਹਦੇ ਨਾਲ ਅਤੇ ਸਾਰੇ ਹੀ ਕਰਵਾਉਂਦੇ ਹੈਗੇ ਇੱਥੇ ਇੱਥੇ ਜਿੰਨੇ ਵੀ ਰਹਿੰਦੇ ਲੋਕ ਸਾਰੇ ਕਰਵਾ ਆਪਾਂ ਪੁੱਛ ਸਕਦੇ ਹਾਂ ਤੋਂ ਬਹੁਤਾ ਖਰਚਾ ਨਹੀਂ ਹੁੰਦਾ ਪੰਜ ਚਾਰ ਸੌ ਦਾ ਖਰਚਾ ਹੁੰਦਾ ਹੈਗਾ ਉਹ ਐਗਰੀਮੈਂਟ ਸਟੈਮ ਪੇਪਰ 'ਤੇ ਬਣ ਜਾਂਦਾ ਉਹ 'ਚ ਸਾਰੀਆਂ ਕੰਡੀਸ਼ਨਾਂ ਲਿਖੀਆਂ ਜਾਂਦੀਆਂ ਉਹਦੇ ਫਿਰ ਤੁਸੀਂ ਵੀ ਮੈਨੂੰ ਇੱਕ ਮਹੀਨੇ ਦੀ ਐਡਵਾਂਸ ਸਕਿਉਰਟੀ ਦਿਓਗੇ ਉਹ ਵੀ ਉਹ 'ਚ ਲਿਖਿਆ ਜਾਏਗਾ ਵੀ ਕਿੰਨੀ ਸਕਿਉਰਟੀ ਦਿੱਤੀ ਇੱਕ ਮਹੀਨੇ ਦਾ ਐਡਵਾਂਸ ਕਿਰਾਇਆ ਦੇਓਗੇ ਅਤੇ ਬਿਜਲੀ ਅਤੇ ਪਾਣੀ ਆ ਜਿਹੜੀ ਉਹ ਅਲੱਗ ਹੋਣਗੇ ਜੋ ਰੇਟ ਚੱਲਦਾ ਹੋਇਆ ਬਿਜਲੀ ਪਾਣੀ ਦਾ ਅਤੇ ਪੋਰਸ਼ਨ ਨਵਾਂ ਅਤੇ ਵਧੀਆ ਬਣਿਆ ਹਾਂ ਨਹੀਂ ਦੇਖੋ ਉਹਦੇ ਨਾਲ ਕੰਟੈਕਟ ਆਪਾਂ ਕਰ ਸਕਦੇ ਹਾਂ ਪਰ ਉਹਦੀ ਤੁਸੀਂ ਆਪਣੇ ਆਪ ਤੁਹਾਨੂੰ ਲਵਾ ਦਾਂਗੇ ਗੱਲ ਤੁਸੀਂ ਆਪ ਕਰਨੀ ਹੈ ਅਤੇ ਜਿਹੜੇ ਹੈਗੇ ਪੇਮੈਂਟ ਤੁਸੀਂ ਉਹਨੂੰ ਅਲੱਗ ਤੋਂ ਕਰਨੀ ਹੈ ਜਿਹੜੀ ਤੁਹਾਡਾ ਏਰੀਆ ਜਿੰਨਾ ਉਹਦੀ ਸਫਈ ਦੀ ਜਿੰਮੇਵਾਰੀ ਤੁਹਾਡੀ ਹੋਏਗੀ ਉਹਦੇ 'ਚ ਕੋਈ ਜਾਣੀ ਕਿ ਇਹ ਨਹੀਂ ਵੀ ਅਸੀਂ ਪ੍ਰੋਡੀਕਲੀ ਕਦੇ ਮਹੀਨੇ ਵੀਹ ਦਿਨ ਬਾਅਦ ਚੈੱਕ ਵੀ ਕਰਿਆ ਕਰਾਂਗੇ ਵੀ ਪ੍ਰੋਪਰ ਸਫਾਈ ਤੁਸੀਂ ਕਰ ਰਹੇ ਹੋ ਕਿ ਨਹੀਂ ਕਿਉਂਕਿ ਅਸੀਂ ਨਵਾਂ ਪੋਰਸ਼ਨ ਬਣਾਇਆ ਸਾਨੂੰ ਇਹ ਹੈ ਵੀ ਇਹ ਠੀਕ ਰਹੇ ਇਹਦੀ ਮੇਟਨੈਂਸ ਹੋਈ ਜਾਵੇ ਬਾਕੀ ਤੁਸੀਂ ਦੇਖ ਲਓ ਏਸੀ ਲੱਗੇ ਹੋਏ ਨੇ ਗੀਜ਼ਰ ਲੱਗੇ ਹੋਏ ਨੇ ਠੀਕ ਆ ਨਾ ਹਾਂ ਇਨਵਰਟਰ ਦੇਖੋ ਹਾਂ ਹਾਂ ਤੁਸੀਂ ਇਨਵੈਟਰ ਲਾ ਸਕਦੇ ਹੋ ਪਰ ਇਹ ਆ ਵੀ ਇਨਵੈਟਰ ਸਾਨੂੰ ਆਪ ਖ੍ਰੀਦਣਾ ਪਏਗਾ ਅਤੇ ਬੈਟਰੀ ਇਨਵਰਟਰ ਦੀ ਆਪ ਖਰੀਦਣੀ ਪਏਗੀ ਹਾਂ ਉਹ ਲੱਗਣ ਦਾ ਪ੍ਰੋਵੀਜ਼ਨ ਹੈਗਾ ਗਾ ਗੈਸ ਦੀ ਪਾਈਪ ਪਈ ਹੋਈ ਆ ਤੁਹਾਨੂੰ ਸਿਲੰਡਰ ਆਪ ਭਰਾਉਣਾ ਪੈਣਾ ਖਾਲੀ ਸਿਲੰਡਰ ਅਸੀਂ ਦੇ ਸਕਦੇ ਆ ਦੇਖੋ ਪਾਣੀ ਪਾਣੀ ਦਾ ਦੇਖੋ ਆਉਂਦਾ ਹੈਗਾ ਜਿਹੜਾ ਸਮਰਸੀਬਲ ਤਾਂ ਨਹੀਂ ਲੱਗਿਆ ਹੋਇਆ ਇੱਥੇ ਅਲਾਊਡ ਨਹੀਂ ਹੈਗਾ ਦੂਜਾ ਸਰਕਾਰੀ ਪਾਣੀ ਆਉਂਦਾ ਹੈਗਾ ਮਿਉਂਸੀਪਲ ਕਮੇਟੀ ਦਾ ਉਹ ਸਾਡੇ ਉੱਪਰ ਟੈਂਕੀ ਚੜ ਜਾਂਦਾ ਸਾਡੇ ਘਰ ਵੈਸੇ ਆਪਣਾ ਟੂਲੂ ਪੰਪ ਮੋਟਰ ਲੱਗੀ ਹੋਈ ਆ ਪਾਣੀ ਉਹ ਉੱਪਰ ਚੜ੍ਹਾ ਦਿੰਦੇ ਆ ਅਤੇ ਉਹਦੇ 'ਚੋਂ ਸਾਨੂੰ ਪਾਣੀ ਦੀ ਦਿੱਕਤ ਨਹੀਂ ਆਵੇਗੀ ਤੁਹਾਨੂੰ ਲਗਾਤਾਰ ਪਾਣੀ ਮਿਲੇਗਾ ਜਦੋਂ ਵੀ ਟੈਂਕੀ ਖਾਲੀ ਹੁੰਦੀ ਆਟੋਮੈਟਿਕ ਮੋਟਰ ਚਲ ਜਾਂਦੀ ਹੈ ਆਟੋਮੈਟਿਕ ਜਿਹੜੀ ਹੈ ਉਹ ਹੋ ਜਾਂਦੀ ਹੈ ਨਹੀਂ ਨਹੀਂ ਉਹ ਉਹ ਉਹ ਨਾ ਨਾ ਨਾ ਉਹ ਹੈਗੀ ਉਹ ਹੈਗੀ ਉਹ ਉਸ ਤਰ੍ਹਾਂ ਦੀ ਸਮਾ ਸੁਵਿਧਾ ਸਾਰੀ ਹੈਗੀ ਆ ਹਮ ਹਮ ਚਲੋ ਚਲੋ ਤੁਸੀਂ ਐਂ ਕਰਿਓ ਫਿਰ ਐਂ ਕਰਿਓ ਤੁਸੀਂ ਸ਼ਾਮ ਨੂੰ ਜਾਂ ਕੱਲ੍ਹ ਆਪਣੇ ਵਾਈਫ ਨਾਲ ਆ ਕੇ ਦਿਖਾ ਲਿਓ ਉਸ ਟਾਈਮ ਆਪਾਂ ਗੱਲ ਕਰ ਲਾਂਗੇ ਠੀਕ ਹੈ ਜੀ ਓਕੇ ਓਕੇ ਜੀ ਓਕੇ ਜੀ ਥੈਂਕ ਯੂ